ਵੈਸੇ ਤਾਂ ਮੈਂ ਖਾਣਾ ਆਪਣੀ ਦਾਦੀ ਜੀ ਅਤੇ ਮੰਮੀ ਮਾਤਾ ਜੀ ਤੋਂ ਬਣਾਉਣਾ ਸਿੱਖਿਆ ਹੈ ਅਤੇ ਉਹ ਬਹੁਤ ਹੀ ਸਵਾਦ ਖਾਣਾ ਬਣਾਉਂਦੇ ਹਨ ਜੇਕਰ ਮੈਂ ਕੁਛ ਖਾਸ ਅਤੇ ਗੁਪਤ ਸਮੱਗਰੀ ਦੀ ਗੱਲ ਕਰਾਂ ਤਾਂ ਉਹਨਾਂ ਵਿੱਚ ਅਸੀਂ ਖੜ੍ਹੇ ਮਸਾਲਿਆਂ ਦਾ ਉਪਯੋਗ ਕਰਦੇ ਹਾਂ ਕਿਉਂਕਿ ਅਸੀਂ ਉਹਨਾਂ ਨੂੰ ਘਰ ਵਿੱਚ ਹੀ ਪੀਸਦੇ ਹਾਂ ਅਤੇ ਪੀਸਣ ਤੋਂ ਬਾਅਦ ਹੀ ਅਸੀਂ ਉਹਨਾਂ ਦਾ ਉਪਯੋਗ ਕਰਦੇ ਹਾਂ ਕਿਉਂਕਿ ਉਹਨਾਂ ਦੀ ਖੁਸ਼ਬੂ ਬਹੁਤ ਹੀ ਵਧੀਆ ਹੁੰਦੀ ਹੈ ਜੋ ਕਿ ਹੋਰਾਂ ਦੇ ਖਾਣੇ ਤੋਂ ਅਲੱਗ ਬਣਾ ਦਿੰਦੀ ਹੈ ਕਿਉਂਕਿ ਅਸੀਂ ਸਬਜ਼ੀਆਂ ਨੂੰ ਵੀ ਧੋ ਕੇ ਚੰਗੀ ਚੰਗੀ ਤਰ੍ਹਾਂ ਧੋ ਕੇ ਅਤੇ ਫਿਰ ਇਸਤੇਮਾਲ ਕਰਦੇ ਹਾਂ ਜਿਸ ਨਾਲ ਖਾਣਾ ਬਹੁਤ ਹੀ ਸਵਾਦ ਬਣਦਾ ਹੈ ਅਤੇ ਇਹੀ ਮੇਰੀ ਇੱਕ ਗੁਪਤ ਸਮੱਗਰੀ ਸੀ